ਮੈਂ ਇੱਕ ਦਿਨ ਨਾ ਫ੍ਰੀ ਬੈਠੀ ਸੀ ਇੱਦਾਂ ਹੀ ਮੈਂ ਫੋਨ ਵਿੱਚ ਨਾ ਔਨਲਾਈਨ ਦੇਖਣ ਲੱਗ ਪਈ ਸਮਾਨ ਜਦੋਂ ਮੈਂ ਨਾ ਸਮਾਨ ਦੇਖਿਆ ਤਾਂ ਮੈਨੂੰ ਵਧੀਆ ਲੱਗਿਆ ਫਿਰ ਮੇਰੇ ਪਾਸ ਨਾ ਇੱਕ ਪਰਸ ਨਹੀਂ ਸੀ ਹੈਗਾ ਔਰ ਮੈਨੂੰ ਪਰਸ ਦੀ ਲੋੜ ਵੀ ਸੀ ਮੇਰਾ ਨਾ ਦੂਸਰਾ ਪੁਰਾਣਾ ਪਰਸ ਫਟ ਗਿਆ ਸੀ ਜਦੋਂ ਮੈਂ ਨਾ ਪਰਸ ਦੇਖੇ ਫੋਨ ਵਿੱਚ ਕੱਢ ਕੇ ਔਨਲਾਈਨ ਤਾਂ ਪਰਸ ਬੜੇ ਸੋਹਣੇ ਸੀ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਉਨ੍ਹਾਂ ਨੂੰ ਖਰੀਦ ਲਵਾਂ ਪਰ ਦਿਲ ਵਿਚ ਇਹ ਵੀ ਡਰ ਸੀ ਕਿ ਜਿਹੜਾ ਆਰਡਰ ਆਵੇਗਾ ਪਤਾ ਨਹੀਂ ਉਹ ਚੀਜ਼ ਵਧੀਆ ਨਿਕਲੇਗੀ ਜਾਂ ਨਹੀਂ ਨਿਕਲੇਗੀ ਪਰ ਫ਼ਿਰ ਵੀ ਮੈਂ ਡਰਦੇ ਡਰਦੇ ਨਾ ਆਰਡਰ ਕਰਤਾ ਕੁਝ ਦਿਨਾਂ ਬਾਅਦ ਨਾ ਫ਼ਿਰ ਉਹ ਪਰਸ ਆਇਆ ਮੇਰੇ ਘਰ ਜਦ ਮੈਂ ਉਹ ਪਾਰਸਲ ਖੋਲ੍ਹ ਕੇ ਦੇਖਿਆ ਤਾਂ ਪਰਸ ਇੰਨਾ ਵਧੀਆ ਸੀ ਨਾ ਬਹੁਤ ਜ਼ਿਆਦਾ ਵਧੀਆ ਸੀ ਬਲੈਕ ਕਲਰ ਦਾ ਸੀ ਔਰ ਉਹਦਾ ਰੇਟ ਵੀ ਸਿਰਫ ਦੋ ਸੌ ਰੁਪਿਆ ਓਹ ਮੇਰੇ ਬਜਟ ਵਿਚ ਵੀ ਸੀ ਤਾਂ ਜਦ ਮੈਂ ਘਰ ਵਿੱਚ ਸਾਰਿਆਂ ਨੂੰ ਦਿਖਾਇਆ ਮੰਮੀ ਹੁਣਾ ਨੂੰ ਸਾਰਿਆਂ ਨੂੰ ਤਾਂ ਉਨ੍ਹਾਂ ਨੇ ਸਾਰਿਆਂ ਨੇ ਬਹੁਤ ਪਸੰਦ ਕਰਿਆ ਕਿਉਂਕਿ ਉਹ ਪਰਸ ਕੋਈ ਯਕੀਨ ਨਹੀਂ ਸੀ ਕਰ ਰਿਹਾ ਕਿ ਵੀ ਉਹ ਦੋ ਸੌ ਦਾ ਰੇਟ ਆ ਉਹਦਾ ਪਰਸ ਦਾ ਸਾਰੇ ਕਹਿ ਰਹੇ ਸੀ ਕਿ ਦੇਖਣ ਨੂੰ ਬਹੁਤ ਮਹਿੰਗਾ ਲੱਗ ਰਿਹਾ ਔਰ ਉਹਦੀ ਕੁਆਲਿਟੀ ਬਹੁਤ ਅੱਛੀ ਸੀ ਪਰਸ ਦੀ ਫ਼ਿਰ ਮੈਂ ਦੂਸਰੇ ਦਿਨ ਉਹ ਡਿਊਟੀ 'ਤੇ ਲੈ ਕੇ ਆਈ ਔਰ ਡਿਊਟੀ ਪਰ ਵੀ ਮੇਰੇ ਸਾਰੇ ਫਰੈਂਡਸ ਨੇ ਬਹੁਤ ਪਸੰਦ ਕਰਿਆ ਕਹਿ ਰਹੀਆਂ ਸੀ ਬਹੁਤ ਮਹਿੰਗਾ ਲੱਗ ਰਿਹਾ ਪਰਸ ਦੇਖਣ ਨੂੰ ਨਹੀਂ ਲੱਗ ਰਿਹਾ ਵੀ ਇਹ ਦੋ ਸੌ ਦਾ ਹੋਵੇਗਾ ਓਹੋ ਇਹਨਾਂ ਜ਼ਿਆਦਾ ਵਧੀਆ ਲੱਗਿਆ ਨਾ ਕਿ ਮੇਰਾ ਦਿਲ ਖੁਸ਼ ਹੋ ਗਿਆ ਉਸ ਚੀਜ਼ ਨੂੰ ਦੇਖ ਕੇ ਔਰ ਮੇਰਾ ਨਾ ਇਹ ਤਜ਼ਰਬਾ ਪਰਸ ਵਾਲਾ ਬਹੁਤ ਵਧੀਆ ਰਿਹਾ